ਹੈਲੋ ਸਿੰਮਟਾ ਇਲੈਕਟ੍ਰੋਨਿਕਸ ਮੈਂ ਦਸ ਦਿਨ ਪਹਿਲਾਂ ਤੁਹਾਡੀ ਦੁਕਾਨ 'ਚੋਂ ਇੱਕ ਐਕੁਆ ਬਿਗਾਰਡ ਦਾ ਆਰ ਓ ਲਿਆ ਸੀ ਅਤੇ ਮੈਂ ਇਸ ਆਰ ਓ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਇਸ ਦਾ ਟੀ ਡੀ ਐੱਸ ਲੈਵਲ ਬਹੁਤ ਅੱਛਾ ਆ ਰਿਹਾ ਹੈ ਅਤੇ ਇਸਦੇ ਵਿੱਚ ਯੂਵੀ ਫੰਕਸ਼ਨ ਵੀ ਹੈ ਜੋ ਕਿ ਬੈਕਟੀਰੀਏ ਨੂੰ ਮਾਰਦਾ ਹੈ ਅਤੇ ਇਸਦੇ ਫਿਲਟਰਾਂ ਰਾਹੀਂ ਵੀ ਬਹੁਤ ਜ਼ਿਆਦਾ ਸਫ਼ਾਈ ਕੀਤੀ ਜਾ ਰਹੀ ਹੈ ਕਿਉਂਕਿ ਸਾਡੇ ਇੱਥੇ ਪਹਿਲਾਂ ਮਿੱਟੀ ਵਾਲਾ ਪਾਣੀ ਆਉਂਦਾ ਸੀ ਅਤੇ ਜਿਹੜਾ ਆਰ ਓ ਵਿੱਚ ਪਾਣੀ ਹੈ ਉਹ ਬਹੁਤ ਜ਼ਿਆਦਾ ਸਾਫ਼ ਹੈ ਇਸ ਤੋਂ ਇਲਾਵਾ ਇਸ ਪਾਣੀ ਦਾ ਟੇਸਟ ਵੀ ਬਹੁਤ ਜ਼ਿਆਦਾ ਅੱਛਾ ਆ ਰਿਹਾ ਹੈ ਅਤੇ ਜੇਕਰ ਕੋ ਮੇਰਾ ਕੋਈ ਰਿਸ਼ਤੇਦਾਰ ਜਾਂ ਕੋਈ ਮੇਰਾ ਮਿੱਤਰ ਪੁੱਛਦਾ ਹੈ ਤਾਂ ਮੈਂ ਤੁਹਾਡੀ ਹੀ ਦੁਕਾਨ ਦਾ ਸੁਝਾਵ ਦੇਵਾਂਗਾ